ਮੇਰਾ ਮਨ ਪਸੰਦ ਜਿਹੜਾ ਕਵੀ ਹੈਗਾ ਹੈ ਉਹ ਮੇਰਾ ਇੱਕ ਦੋਸਤ ਹੀ ਹੈਗਾ ਉਹਦਾ ਨਾਮ ਬਲਜੀਤ ਸਿੰਘ ਹੈ ਬਹੁਤ ਵਧੀਆ ਕਵਿਤਾਵਾਂ ਲਿਖਦਾ ਹੈਗਾ ਹੈ ਉਹ ਉਹਦਾ ਮੈਨੂੰ ਜਿਹੜੀਆਂ ਕਵਿਤਾਵਾਂ ਪਸੰਦ ਆਉਣ ਦਾ ਇੱਕੋ ਇੱਕ ਜਿਹੜਾ ਬਹੁਤ ਵਧੀਆ ਕਾਰਨ ਹੈਗਾ ਉਹ ਹੈਗਾ ਉਹ ਜੋ ਉਹਦੇ ਜ਼ਿੰਦਗੀ ਵਿੱਚ ਜੋ ਉਹਦੇ ਜ਼ਿੰਦਗੀ ਵਿੱਚ ਚੱਲਦਾ ਹੈਗਾ ਹੈ ਜੋ ਆਲਾ ਦੁਆਲਾ ਦੇਖਦਾ ਹੈਗਾ ਹੈ ਕਿਉਂਕਿ ਉਹੀ ਲਿਖਦਾ ਹੈਗਾ ਹੈ ਉਹ ਉਹਨੂੰ ਮਤਲਬ ਜਿੱਦਾਂ ਮੈਂ ਹੈ ਮੈਂ ਸਮਾਜ ਸੇਵੀ ਜਾ ਸੋਸ਼ਲ ਸਰਵਿਸ ਵਾਲੀਆਂ ਜਿਹੜੀਆਂ ਕਵਿਤਾਵਾਂ ਹੈਗੀਆਂ ਹੈ ਉਹ ਬੜੀਆ ਪਸੰਦ ਕਰਦਾ ਹੈਗਾ ਹੈ ਉਹਨੇ ਬੜੀਆਂ ਵਧੀਆਂ ਕਵਿਤਾਵਾਂ ਲਿਖੀਆਂ ਹੈਗੀਆਂ ਹੈ ਜਿੱਦਾਂ ਉਹਨੇ ਇੱਕ ਕਵਿਤਾਵਾ ਲਿਖੀ ਸੀਗੀ ਧੀਆਂ ਫਿਰ ਕਿਉਂ ਕਹਿੰਦੇ ਲੋਕੀ ਸਿਰ 'ਤੇ ਭਾਰ ਹੁੰਦੀਆਂ ਧੀਆਂ ਉਹ ਮੈਨੂੰ ਬੜੀ ਵਧੀਆ ਲੱਗੀ ਹੈਗੀ ਹੈ ਇੱਕ ਬਾਪੂ 'ਤੇ ਲਿਖੀ ਸੀਗੀ ਇੱਕ ਮਾਂ 'ਤੇ ਲਿਖੀ ਸੀਗੀ ਉਹਨੇ ਕਵਿਤਾ ਉਹ ਬੜੀ ਵਧੀਆ ਲੱਗੀ ਹੈਗੀ ਹੈ ਮੈਨੂੰ ਉਹਦੇ ਬਾਰੇ ਮੈਂ ਇਹੀ ਕਹਿਣਾ ਚਾਹੁੰਦਾ ਹੈਗਾ ਤੁਸੀਂ ਵੀ ਮਤਲਬ ਉਦੇ ਜਿਹੜਾ ਕਵਿਤਾਵਾਂ ਲਿਖਣ ਦਾ ਢੰਗ ਹੈਗਾ ਹੈ ਉਹ ਬੜਾ ਬਹੁਤ ਵਧੀਆ ਢੰਗ ਹੈਗਾ ਅਤੇ ਇੱਦਾਂ ਹੈ ਦੇਖੋ ਕਵਿਤਾਵਾਂ ਉਹਦੀ ਕਵਿਤਾ ਲਿਖੀ ਪੜ੍ਹਦਾ ਹੈਗਾ ਤਾਂ ਬੰਦੇ ਨੂੰ ਮੋਹਰੇ ਵਾਲਿਆ ਨੂੰ ਕੀਲ ਕੇ ਰੱਖ ਦਿੰਦਾ ਹੈਗਾ ਹੈ ਉਹ ਇਸ ਢੰਗ ਦੀ ਕਵਿਤਾ ਲਿਖਦਾ ਹੈਗਾ ਹੈ ਉਹ ਇਸ ਕਰਕੇ ਮੈਨੂੰ ਉਹਦੀ ਜਿਹੜੀ ਕਵਿਤਾ ਜਾਂ ਲਿਖਣ ਸ਼ੈਲੀ ਹੈਗੀ ਹੈ ਉਹ ਮੈਨੂੰ ਬੜੀ ਵਧੀਆ ਲੱਗਦੀ ਹੈਗੀ ਹੈ ਮੈਨੂੰ ਬਹੁਤ ਪਸੰਦ ਹੈਗੀ ਹੈ ਉਹਦੀ ਲਿਖਣ ਸ਼ੈਲੀ